ਮੈਂ ਇਸ ਚੀਜ਼ ਨੂੰ ਇੱਦਾਂ ਦੇਖਦੀ ਹਾਂ ਕਿ ਸਾਡੀ ਪੰਜਾਬੀ ਪੰਜਾਬੀ ਨੂੰ ਹੋਰ ਕਿੱਦਾਂ ਅਸੀਂ ਤੁਲਨਾ ਕਰ ਸਕਦੇ ਹਾਂ ਜਿਹੜੇ ਹੋਰ ਭਾਸ਼ਾਵਾਂ ਮੈਂ ਜਾਣਦੀ ਹਾਂ ਪੰਜਾਬ ਜਿਹੜੀ ਹੈ ਪੰਜਾਬੀ ਜਿਹੜੀ ਸਾਡੀ ਭਾਸ਼ਾ ਹੈ ਉਹ ਸਿਰਫ਼ ਪੰਜਾਬੀ ਹੀ ਜਾਣਦੇ ਆ ਜਿਹੜੇ ਪੰਜਾਬ 'ਚ ਰਹਿੰਦੇ ਹੈ ਜਾਂ ਜਿਹੜੇ ਪੰਜਾਬ ਤੋਂ ਬਾਹਰ ਵੀ ਚਲੇ ਜਾਂਦੇ ਆ ਮਤਲਬ ਕਿ ਪੰਜਾਬੀ ਲੇਕਿਨ ਜੇ ਪੰਜਾਬੀਆਂ ਨੇ ਹੋਰ ਕਿਸੇ ਨਾਲ ਆਪਣਾ ਬਣਾਉਣਾ ਹੈ ਕੋਂਟੈਕਟ ਬਣਾਉਣਾ ਹੈ ਹੋਰ ਕਿਸੇ ਨਾਲ ਗੱਲਬਾਤ ਕਰਨੀ ਹੈ ਕੋਈ ਆਪਣੇ ਵੈ ਵਪਾਰ ਦੇ ਸੰਬੰਧ ਬਣਾਉਣੇ ਨੇ ਜਾਂ ਕੁਛ ਕਰਨਾ ਹੈ ਤਾਂ ਉਹਨਾਂ ਨੂੰ ਹੋਰ ਲੈਂਗੁਏਜ਼ ਆਉਣੀ ਵੀ ਜ਼ਰੂਰੀ ਹੈ ਜਿੱਦਾਂ ਕਿ ਅੰਗਰੇਜ਼ੀ ਅੰਗਰੇਜ਼ੀ ਇੱਕ ਗਲੋਬਲ ਭਾਸ਼ਾ ਹੈਗੀ ਹੈ ਜੇ ਤੁਸੀਂ ਅੱਜ ਇੱਥੋਂ ਦੁਨੀਆਂ 'ਚ ਕਿਸੇ ਵੀ ਬੰਦੇ ਨਾਲ ਕੋਂ ਗੱਲ ਕਰਨਾ ਚਾਹੁੰਦੇ ਹੋ ਤੁਹਾਨੂੰ ਇੰਗਲਿਸ਼ ਆਉਣੀ ਤੁਹਾਨੂੰ ਪ ਅੰਗਰੇਜ਼ੀ ਆਉਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਅੰਗਰੇਜ਼ੀ ਆਉਂਦੀ ਤਾਂ ਤੁਸੀਂ ਗੱਲ ਕਰ ਲੋਂਗੇ ਪਰ ਪੰਜਾਬੀ ਨਾਲ ਇੱਦਾਂ ਨਹੀਂ ਹੈ ਪੰਜਾਬੀ ਜੇ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਸਿਰਫ਼ ਦੂ ਉਸ ਹੀ ਬੰਦੇ ਨਾਲ ਗੱਲ ਕਰ ਪਾਓਗੇ ਜਿਹਨੂੰ ਪੰਜਾਬੀ ਆਉਂਦੀ ਹੈ ਅਤੇ ਜੇ ਅਸੀਂ ਜੇਕਰ ਹਿੰਦੀ ਦੀ ਗੱਲ ਕਰੀਏ ਤਾਂ ਅਸੀਂ ਪੰਜਾਬ ਤੋਂ ਬਾਹਰ ਜਾ ਕੇ ਵੀ ਬਹੁਤ ਸਾਰੇ ਲੋਕਾਂ ਨਾਲ ਗੱਲ ਕਰ ਸਕਦੇ ਹਾਂ ਜਿਨ੍ਹਾਂ ਨੂੰ ਹਿੰਦੀ ਆਉਂਦੀ ਹੈ ਕਿਉਂਕਿ ਹਿੰਦੀ ਇੱਕ ਤਰ੍ਹਾਂ ਦੀ ਨੈਸ਼ਨਲ ਭਾਸ਼ਾ ਮੰਨੀ ਜਾਂਦੀ ਹੈ ਹਾਲਾਂਕਿ ਇਹਦਾ ਕੋਈ ਸਟੇਟਸ ਨਹੀਂ ਹੈ ਨੈਸ਼ਨਲ ਭਾਸ਼ਾ ਵਾਲਾ ਲੇਕਿਨ ਜਿਹੜੇ ਜ਼ਿਆਦਾ ਸਪੀਕਰਜ਼ ਹੁੰਦੇ ਨੇ ਜਿਹੜੀ ਲੈਂਗੁਏਜ ਦੇ ਆਪਾਂ ਉਹਨੂੰ ਕਹਿ ਦਿੰਦੇ ਹਾਂ ਅਤੇ ਪੰਜਾਬੀ ਜੇ ਅਸੀਂ ਹੋਰਾਂ ਨਾਲ ਅਸੀਂ ਜੇ ਜੁੜਨਾ ਵਾ ਜੇ ਹੋਰ ਜਗ੍ਹਾ 'ਚ ਜੁੜਨਾ ਹੈ ਅਸੀਂ ਲੋਕਾਂ ਨਾਲ ਜੁੜਨਾ ਹੈ ਕੰਮ ਵਾਸ ਵਾਸਤੇ ਹਰ ਚੀਜ਼ ਵਾਸਤੇ ਤਾਂ ਉਸ ਵਾਸਤੇ ਸਾਨੂੰ ਬਹੁਤ ਜ਼ਰੂਰੀ ਹੈ ਕਿ ਸਾਡੀ ਪੰਜਾਬੀ ਤੋਂ ਇਲਾਵਾ ਵੀ ਸਾਨੂੰ ਹੋਰ ਲੈਂਗੂਏਜ਼ਿਸ ਵੀ ਆਉਣ